ਪੜ੍ਹਾਈ ਦੇ ਪੱਖੋਂ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਕਿਸੇ ਵੀ ਵਿਦਿਆਰਥੀ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪੜ੍ਹਾਈ ਮੌਜੂਦ ਹੈ ਜੋ ਵੀ ਤੁਸੀਂ ਕਰਨੀ ਚਾਹੁੰਦੇ ਹੋ ਜਿਵੇਂ ਕਿ ਸਾਡੇ ਜ਼ਿਲ੍ਹੇ ਵਿੱਚ ਮਾਤਾ ਗੁਜਰੀ ਕੋ ਮਾਤਾ ਗੁਜਰੀ ਕੋਲਜ ਆਟੋਨੋਮਸ ਕਾਲਜ ਹੈ ਜਿਸ ਵਿੱਚ ਬੀ ਏ ਬੀ ਏ ਐੱਮ ਏ ਐੱਮ ਐੱਡ ਵੋਕੇਸ਼ਨਲ ਕੋਰਸ ਬੀ ਏ ਐੱਮ ਬੀ ਏ ਬੀ ਸੀ ਏ ਆਦਿ ਕਰਾਏ ਜਾਂਦੇ ਹਨ ਅਤੇ ਨਾਲ ਹੀ ਜੇ ਕਿਸੇ ਬੱਚੇ ਨੇ ਕੋਈ ਡਿਗਰੀ ਕੋਰਸ ਕਰਨੀ ਹੈ ਤਾਂ ਨਾਲ ਹੀ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਡਿਗਰੀ ਕਾਲਜ ਹੈ ਜਿਸ ਵਿੱਚ ਪੰਜ ਵਿਸ਼ਿਆਂ 'ਤੇ ਡਿਗਰੀ ਕਰਾਈ ਜਾਂਦੀ ਹੈ ਜਿਸ ਵਿੱਚ ਬੀ ਟੈਕ ਸੀ ਐੱਸ ਸੀ ਬੀ ਟੈਕ ਮਕੈਨੀਕਲ ਬੀ ਟੈਕ ਇਲੈਕਟ੍ਰੀਕਲ ਬੀ ਟੈਕ ਇਲੈਕਟ੍ਰੋਨਿਕ ਬੀ ਟੈਕ ਸਿਵਲ ਅਤੇ ਨਾਲ ਐੱਮ ਬੀ ਏ ਬੀ ਬੀ ਏ ਬੀ ਸੀ ਏ ਵੀ ਕਰਾਈ ਜਾਂਦੀ ਹੈ ਅਤੇ ਉਸਦੇ ਨਾਲ ਵ ਵੋਕੇਸ਼ਨਲ ਕੋਰਸ ਵੀ ਹਨ ਜਿਵੇਂ ਸੋਫਟਵੇਅਰ ਸੋਲਰ ਸਿਸਟਮ ਇਲੈਕਟ੍ਰੋਨਿਕਸ ਐਂਡ ਸਿਵਲ ਇਹ ਚਾਰ ਸੋ ਕੋਰਸ ਹਨ ਅਤੇ ਉਸ ਸਾਡੇ ਕਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਗਰੀਬ ਬੱਚਿਆਂ ਜਿਵੇਂ ਪੰਜਾਬ ਸਰਕਾਰ ਵਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਐੱਸ ਸੀ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਹੈ ਤਾਂ ਜੋ ਇਸ ਕਰਕੇ ਹੋਰ ਬੱਚੇ ਵੀ ਇੱਥੇ ਪੜ੍ਹਨ ਲਈ ਆਉਣ ਹੋਰ ਜਿਨ੍ਹਾਂ ਤੋਂ ਬੱਚੇ ਵੀ ਇੱਥੇ ਪੜ੍ਹਨ ਲਈ ਆਉਂਦੇ ਹਨ ਅਤੇ ਬਿਹਾਰ ਦਾ ਬਹੁਤ ਬੱਚਾ ਡੀ ਆਰ ਸੀ ਦੇ ਕ ਥਰੂ ਸਾਡੇ ਕਾਲ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਵਿੱਚ ਪੜ੍ਹਨ ਆਉਂਦਾ ਹੈ ਅਤੇ ਸਾਡੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹੈ ਜਿਸ ਵਿੱਚ ਵੀ ਬਹੁਤ ਸਾਰੇ ਕੋਰਸ ਕਰਾਏ ਜਾਂਦੇ ਹਨ ਜਿਵੇਂ ਵੀ ਬੱਚਿਆਂ ਦੀ ਜਿਸ ਵੀ ਕੋਲਜ 'ਚ ਜਾਣ ਦੀ ਚੋਆਇਸ ਆ ਸਾਡੇ ਖਾਸ ਸਭ ਕੁਛ ਸਾਡੇ ਕੋਲ ਉਪਲਬਧ ਹੈ ਅਤੇ ਸਾਨੂੰ ਬਾਹਰ ਜਾਣ ਦੀ ਕੁਛ ਵੀ ਜ਼ਰੂਰਤ ਨਹੀਂ ਹੈ ਜੇ ਕਿਸੇ ਬੱਚੇ ਨੇ ਕੋਈ ਬੀ ਐੱਡ ਕਰਨੀ ਹੈ ਤਾਂ ਉਹ ਕਾਲਜ ਵੀ ਸਾਡੇ ਜ਼ਿਲ੍ਹੇ 'ਚ ਹੈ ਜੇ ਕਿਸੇ ਨੇ ਲਾਅ ਕਰਨੀ ਹੈ ਉਹ ਕਾਲਜ ਵੀ ਸਾਡੇ ਜ਼ਿਲ੍ਹੇ 'ਚ ਹੈ ਲਿੰਕ ਕਾਵਾ ਲਿੰਕਲ ਕਾਲਜ ਆਫ ਲਾਅ ਸਾਡੇ ਜ਼ਿਲ੍ਹੇ 'ਚ ਹੈ ਇਸ ਲਈ ਸਾਡੇ ਜ਼ਿਲ੍ਹੇ ਦੇ ਪੜ੍ਹਾਈ ਪੱਖੋਂ ਬਹੁਤ ਜ਼ਿਆਦਾ ਸਹੂਲਤਾਂ ਹਨ ਇਸ ਪੜ੍ਹਾਈ ਦੇ ਤਰਫੋਂ ਹਰ ਸਾਡੇ ਜ਼ਿਲ੍ਹੇ ਦੇ ਕਿਸੇ ਵੀ ਬੱਚੇ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਸਾਰੇ ਹੋਰ ਜ਼ਿਲਿਆਂ ਦੇ ਬੱਚੇ ਵੀ ਇੱਥੇ ਐਜੂਕੇਸ਼ਨ ਲੈਣ ਆਉਂਦੇ ਹਨ